ਹਾਂਜੀ ਤੁਸੀਂ ਕਿੱਥੇ ਖੜ੍ਹੇ ਹੋ ਆਏ ਨਹੀਂ ਕੈਬ ਲੈ ਕੇ ਅਜੇ ਤੱਕ ਮੈਂ ਬਹੁਤ ਲੇਟ ਹੋ ਰਹੀ ਹਾਂ ਜਲਦੀ ਆਉ ਮੈਂ ਇਸ ਸਟੇਸ਼ਨ 'ਤੇ ਖੜ੍ਹੀ ਹਾਂ